ਮੈਨੂੰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਮੈਂ ਬਹੁਤ ਤਰ੍ਹਾਂ ਦੀਆਂ ਪੇਂਟਿੰਗਾਂ ਸਿੱਖੀਆਂ ਹਨ ਮੈਂ ਇਹ ਸਭ ਕੁਛ ਆਪਣੇ ਗੁਰੂ ਜੀ ਕੋ ਸਿੱਖਿਆ ਹੈ ਉਨ੍ਹਾਂ ਨੇ ਮੈਨੂੰ ਪੇਂਟਿੰਗ ਕਰਨਾ ਸਿਖਾਇਆ ਹੈ ਮੈਨੂੰ ਬਚਪਨ ਤੋਂ ਹੀ ਪੇਂਟਿੰਗ ਦਾ ਬਹੁਤ ਸ਼ੋਂਕ ਸੀ ਮੈਂ ਆਪਣੀ ਕਾਪੀ ਤੇ ਬਹੁਤ ਤਰ੍ਹਾਂ ਦੀਆਂ ਪੇਂਟਿੰਗਾਂ ਬਣਾਈਆਂ ਹਨ ਛੋਟੇ ਹੁੰਦੇ ਤੋਂ ਹੀ ਮੈਂ ਪੇਂਟਿੰਗਾਂ ਸ਼ੁਰੂ ਕਰ ਤੀਆਂ ਹਨ ਅਤੇ ਹੁਣ ਮੈਨੂੰ ਪੇਂਟਿੰਗ ਬਹੁਤ ਤਰ੍ਹਾਂ ਦੀਆਂ ਆ ਗਈਆਂ ਹਨ ਮੈਂ ਬਹੁਤ ਤਰ੍ਹਾਂ ਦੇ ਦ੍ਰਿਸ਼ ਵੇਖ ਕੇ ਪੇਂਟਿਗ਼ਾਂ ਬਣਾਈਆਂ ਹਨ ਪੇਂਟਿੰਗਾਂ ਬਣਾਉਣ ਨਾਲ਼ ਮੇਰਾ ਮਨ ਵੀ ਆਕਰਸ਼ਿਕ ਹੁੰਦਾ ਹੈ ਮੈਂ ਪਾਰਕ ਵਿੱਚ ਜਾ ਕੇ ਬਹੁਤ ਪੇਂਟਿੰਗਾਂ ਬਣਾਈਆਂ ਹਨ ਜਿਸ ਨਾਲ਼ ਮੇਰਾ ਮਨ ਕੁਦਰਤ ਵੱਲ ਖਿੱਚਿਆ ਗਿਆ ਹੈ ਮੈਨੂੰ ਪੇਂਟਿੰਗ ਨਾਲ਼ ਕੁਦਰਤ ਨਾਲ਼ ਵੀ ਪਿਆਰ ਹੋ ਗਿਆ ਹੈ ਸਾਨੂੰ ਕੁਦਰਤ ਨਾਲ਼ ਪਿਆਰ ਰੱਖਣਾ ਚਾਹੀਦਾ ਹੈ ਪੇਂਟਿੰਗ ਇੱਕ ਬਹੁਤ ਵਧੀਆ ਚੀਜ਼ ਹੈ ਮੈਂ ਬਹੁਤ ਚੀਜ਼ਾਂ ਦੀ ਪੇਂਟਿੰਗਾਂ ਬਣਾਈਆਂ ਹਨ ਕੁਦਰਤ ਦੇ ਕਿਤਨੇ ਦ੍ਰਿਸ਼ਾਂ ਦੀਆਂ ਪੇਂਟਿੰਗਾਂ ਬਣਾਈਆਂ ਹਨ ਪਹਾੜਾਂ ਦੀਆਂ ਪੇਂਟਿੰਗਾਂ ਬਣਾਈਆਂ ਹਨ ਪੇਂਟਿੰਗ ਮੇਰਾ ਰੁਤਬਾ ਹੈ ਮੈਂ ਬਹੁਤ ਸਾਰੀ ਇਮਾਰਤਾਂ ਜਾ ਵਿੱਚ ਜਾ ਕੇ ਉਹਨਾਂ ਦੀ ਪੇਂਟਿੰਗ ਬਣਾਈ ਹੈ